ਜਿੱਦਾਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੀ ਹੋ ਭੰਗੜਾ ਪੰਜਾਬੀਆਂ ਦੀ ਸ਼ਾਨ ਹੈ ਭੰਗੜੇ ਤੋਂ ਬਿਨਾਂ ਪੰਜਾਬੀ ਜਾਨੇ ਹੀ ਨਹੀਂ ਜਾਂਦੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਪ੍ਰਮੁੱਖ ਜਿਹੜਾ ਨਾਚ ਹੈ ਉਹ ਭੰਗੜਾ ਹੀ ਹੈ ਭੰਗੜਾ ਸ ਉਨਾ ਹੀ ਪੰਜਾਬੀਆ ਲਈ ਜ਼ਰੂਰੀ ਹੈ ਜਿੰਨਾ ਕਿ ਹਰ ਇੱਕ ਪੰਜਾਬੀ ਲਈ ਰੋਟੀ ਖਾਣਾ ਜ਼ਰੂਰੀ ਹੈ ਭੰਗੜਾ ਹੋਰਾਂ ਨਾਲੋਂ ਅਲੱਗ ਕਿਸ ਕਿਉਂ ਹੈ ਮੁਖਯ ਪ੍ਰਸ਼ਨ ਇਹ ਵੈ ਭੰਗੜਾ ਇਸ ਕਰਕੇ ਅਲੱਗ ਹੈ ਭੰਗੜਾ ਸਾਡੇ ਇੱਕ ਸਰੀਰਕ ਤੌਰ 'ਤੇ ਬਹੁਤ ਵਧੀਆ ਹੈ ਭੰਗੜਾ ਪਾਉਣ ਦੇ ਨਾਲ ਸਾਡਾ ਸਾਡੇ ਸਰੀਰ ਦੇ ਰੋਗ ਵੀ ਦੂਰ ਹੁੰਦੇ ਹਨ ਸਭ ਸੇ ਵੱਡਾ ਕਾਰਨ ਭੰਗੜਾ ਪਾਉਣ ਦੇ ਨਾਲ ਕਦੀ ਵੀ ਕਿਸੀ ਨੂੰ ਮੋਟਾਪਾ ਨਹੀਂ ਆ ਸਕਦਾ ਇਹਦੇ ਨਾਲ ਹੋਰ ਵੀ ਕਈ ਕਿਸਮ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਭੰਗੜਾ ਵੈਸੇ ਵੀ ਜੋਸ਼ੀਲਾ ਗਾਨਿਆਂ ਦੇ ਉੱਤੇ ਗਾਇਆ ਜਾਂਦਾ ਹੈ ਭੰਗੜੇ ਦੇ ਵਿੱਚ ਕਈ ਕਾਰਨ ਹਨ ਜੋ ਇਹ ਹੋਰਾ ਡਾਂਸ ਨਾਲੋਂ ਵੱਖਰਾ ਮਹਿਸੂਸ ਕਰਵਾਉਂਦਾ ਹੈ ਇਹ ਨੂੰ ਹਰ ਇੱਕ ਉਮਰ ਦੇ ਲੋਕ ਪਾਉਂਦੇ ਹਨ ਕਿ ਛੋਟਾ ਕੀ ਵੱਡਾ ਕੀ ਬਜ਼ੁਰਗ ਕੀ ਇਸ ਕਰਕੇ ਇਹ ਹੋਰਾ ਨਾਲੋਂ ਅਲੱਗ ਹੈ